ਜੇ ਅਸੀਂ ਯਾਤਰਾ ਦੀ ਗੱਲ ਕਰੀਏ ਤਾਂ ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਯਾਤਰਾਵਾਂ ਕੀਤੀਆਂ ਹਨ ਪਰ ਜੇ ਸਭ ਤੋਂ ਲੰਬੀ ਯਾਤਰਾ ਦੀ ਗੱਲ ਕਰੀਏ ਤਾਂ ਮੇਰੀ ਸਭ ਤੋਂ ਜ਼ਿਆਦਾ ਲੰਬੀ ਯਾਤਰਾ ਜੋ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕੀਤੀ ਹੈ ਉਹ ਹੈ ਖੀਰ ਗੰਗਾ ਦੀ ਖੀਰ ਗੰਗਾ ਇੱਕ ਪਹਾੜੀ ਸਟੇਸ਼ਨ ਹੈ ਜਿਸਨੂੰ ਅਸੀਂ ਹਿੱਲ ਸਟੇਸ਼ਨ ਵੀ ਕਹਿੰਦੇ ਹਾਂ ਜਿੱਥੇ ਜੋ ਕਿ ਮੇਰੇ ਘਰ ਤੋਂ ਚਾਰ ਸੌ ਪੰਜਾਹ ਕਿਲੋਮੀਟਰ ਦੀ ਦੂਰੀ 'ਤੇ ਹੈ ਉਸ ਨੂੰ ਚ ਚਾਰ ਸੌ ਪੰਜਾਹ ਕਿਲੋਮੀਟਰ ਅਸੀਂ ਕਾਰ ਰਾਹੀਂ ਤੈਅ ਕੀਤਾ ਅਤੇ ਉਸ ਤੋਂ ਬਾਅਦ ਸੋਲ੍ਹਾਂ ਕਿਲੋਮੀਟਰ ਅਸੀਂ ਪੈਦਲ ਯਾਤਰਾ ਰਾਹੀਂ ਤੈਅ ਕੀਤਾ ਜੇ ਆਪਾਂ ਗੱਲ ਕਰੀਏ ਔਖੇ ਦੀ ਤਾਂ ਪਹਾੜੀ ਰਸਤਾ ਹੋਣ ਕਰਕੇ ਔਖਾ ਵੀ ਸੀ ਪਰ ਔਖੇ ਦੇ ਨਾਲ ਨਾਲ ਮਨੋਰੰਜਨ ਦਾਇਕ ਵੀ ਸੀ ਕਿਉਂਕਿ ਉੱਥੇ ਅਸੀਂ ਨੈਚੁਰਲ ਝਰਨੇ ਜਿਨ੍ਹਾਂ ਨੂੰ ਕਿ ਅਸੀਂ ਦੇਸੀ ਭਾਸ਼ਾ ਵਿੱਚ ਕਹੀਏ ਕਿ ਕੁਦਰਤ ਦੀ ਖੂਬਸੂਰਤੀ ਦੇਖੀ ਅਤੇ ਆਪਣਾ ਜੋ ਟਾਈਮ ਸੀ ਉਸ ਨੂੰ ਵਧੀਆ ਬਿਤਾਇਆ ਉੱਥੋਂ ਦਾ ਮੌਸਮ ਬਹੁਤ ਵਧੀਆ ਸੀ ਉੱਥੋਂ ਦੀ ਹਵਾ ਤਾਜ਼ੀ ਸੀ ਖਾਣ ਪੀਣ ਸ਼ੁੱਧ ਸੀ ਪਰ ਜੇ ਆਪਾਂ ਯਾਤਰਾ ਦੀ ਗੱਲ ਕਰੀਏ ਯਾਤਰਾ ਲੰਬੀ ਜ਼ਰੂਰ ਸੀ ਪਰ ਲੰਬੀ ਯਾਤਰਾ ਦੇ ਨਾਲ ਨਾਲ ਉਸਦਾ ਫ਼ਾਇਦਾ ਇਹ ਸੀ ਕਿ ਉੱਥੇ ਜਾ ਕੇ ਸਾਨੂੰ ਸੌਖ ਬਹੁਤ ਮਹਿਸੂਸ ਹੋਈ ਅਤੇ ਅਸੀਂ ਆਪਣੀ ਯਾਤਰਾ ਦੀ ਜੋ ਔਖ ਸੀ ਉਹ ਭੁੱਲ ਗਏ ਤਾਂ ਇਹ ਯਾਤਰਾ ਤੈਅ ਕਰਕੇ ਸਾਨੂੰ ਸਕੂਨ ਬਹੁਤ ਮਿਲਿਆ ਅਤੇ ਅਸੀਂ ਆਪਣੀ ਇੱਕ ਜਿਵੇਂ ਫਰੈਸ਼ ਕਹਿ ਸਕਦੇ ਹਾਂ ਕਿ ਤਰੋ ਤਾਜ਼ਾ ਜ਼ਿੰਦਗੀ ਦੁਬਾਰਾ ਸ਼ੁਰੂ ਕੀਤੀ ਧੰਨਵਾਦ